ਵੀਹ ਦਸ ਦੋ ਹਜ਼ਾਰ ਇੱਕ ਛੇ ਛੇ ਦੋ ਹਜ਼ਾਰ ਤਿੰਨ ਇੱਕ ਚਾਰ ਦੋ ਹਜ਼ਾਰ ਪੰਜ ਨੌ ਨੌ ਦੋ ਹਜ਼ਾਰ ਛੇ ਇੱਕ ਦੋ ਦੋ ਹਜ਼ਾਰ ਤਿੰਨ